ਨਵੇਂ ਜਨਮੇ ਬੱਚੇ ਨੂੰ ਜਨਮ ਦੌਰਾਨ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਅਤੇ ਉਸ ਦੀ ਦੇਖ ਭਾਲ ਲਈ ਉਸ ਦੇ ਆਲੇ ਦੁਆਲੇ ਬਹੁਤ ਚੰਗੀ ਤਰ੍ਹਾਂ ਸਫਾਈ ਦਾ ਧਿਆਨ ਰੱਖਣਾ ਪੈਂਦਾ ਹੈ ਅਤੇ ਉਸ ਨੂੰ ਮਾਂ ਦੇ ਦੁੱਧ ਤੋਂ ਬਾਅਦ ਹੌਲੀ ਹੌਲੀ ਜਿਵੇਂ ਜਿਵੇਂ ਉਸ 'ਤੇ ਦਿਨ ਮਹੀਨੇ ਵੱਡੇ ਹੁੰਦੇ ਜਾਂਦੇ ਹਨ ਉਸ ਨੂੰ ਹਲਕਾ ਖਾਣ ਪੀਣ ਲਈ ਦੇਣਾ ਚਾਹੀਦਾ ਹੈ ਦਲੀਆ ਖਿਚੜੀ ਦਲੀਆ ਵਗੈਰਾ ਦੇਣਾ ਚਾਹੀਦਾ ਹੈ ਬੱਚਿਆਂ ਵਾਲਾ ਭੋਜਨ ਖਵਾਉਣਾ ਚਾਹੀਦਾ ਹੈ ਘੱਟ ਲੂਣ ਮਿਰਚ ਵਾਲਾ ਭੋਜਨ ਖਵਾਉਣਾ ਚਾਹੀਦਾ ਹੈ ਕਿਉਂਕਿ ਬੱਚੇ ਦੇ ਜਨਮ ਹੋਣ ਤੁਰੰਤ ਛੋਟੇ ਬੱਚਿਆਂ ਦੀ ਪਾਚਨ ਸ਼ਕਤੀ ਅਤੇ ਫੂਡ ਪ੍ਰਣਾਲੀ ਭੋਜਨ ਪ੍ਰਣਾਲੀ ਉਹਨਾਂ ਦੀ ਕਮਜ਼ੋਰ ਹੁੰਦੀ ਹੈ ਉਹਨਾਂ ਨੂੰ ਹਲਕਾ ਅਤੇ ਨਾਜ਼ੁਕ ਖਾਣਾ ਘੱਟ ਲੂਣ ਮਿਰਚ ਵਾਲਾ ਹੀ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਜਲਦੀ ਹਾਜ਼ਮ ਹੋ ਸਕੇ ਭਾਰੀ ਭੋਜਨ ਉਹਨਾਂ ਨੂੰ ਨਹੀਂ ਖਵਾਉਣਾ ਚਾਹੀਦਾ ਹਜੇ ਉਸ ਦੀ ਉਮਰ ਛੋਟੀ ਹੋਣ ਦੇ ਕਾਰਨ ਉਹਨਾਂ ਨੂੰ ਹਲਕਾ ਹੀ ਭੋਜਨ ਖਵਾਉਣਾ ਚਾਹੀਦਾ ਹੈ ਉਸ ਦੀ ਦੇਖਭਾਲ ਲਈ ਉਸ ਨੂੰ ਹਰ ਰੋਜ਼ ਮੌਸਮ ਅਨੁਸਾਰ ਪਾਣੀ ਗੁਣਗੁਣਾ ਰੱਖ ਕੇ ਉਸ ਨੂੰ ਨਹਾਉਣਾ ਚਾਹੀਦਾ ਹੈ ਅਤੇ ਨਹਾਉਣ ਤੋਂ ਬਾਅਦ ਅਤੇ ਨਹਾਉਣ ਤੋਂ ਪਹਿਲਾਂ ਨਹਾਉਣ ਤੋਂ ਬਾਅਦ ਉਸ ਦੇ ਸਰੀਰ ਦੀ ਚੰਗੀ ਤਰ੍ਹਾਂ ਅੱਛੇ ਤਰੀਕੇ ਨਾਲ ਮਾਲਿਸ਼ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਨਹਾ ਕੇ ਧੁਲਾ ਕੇ ਅਤੇ ਦੁੱਧ ਨੂੰ ਦੁੱਧ ਪਿਆਉਣਾ ਚਾਹੀਦਾ ਹੈ ਦੁੱਧ ਪਿਆ ਕੇ ਉਸਨੂੰ ਆਪਣੇ ਦਲੀਆ ਖਵਾਉਣਾ ਚਾਹੀਦਾ ਹੈ ਦਲੀਆ ਖਵਾ ਕੇ ਉਸ ਨੂੰ ਇੱਕ ਚੰਗੀ ਨੀਂਦ ਸਵਾਉਣਾ ਚਾਹੀਦਾ ਹੈ ਤਾਂ ਕਿ ਉਸ ਦੇ ਤੰਦਰੁਸਤੀ ਦਾ ਅਸਲੀ ਖੁਰਾਕ ਹੀ ਉਸ ਨੂੰ ਸਮੇਂ ਸਿਰ ਨੀਂਦ ਆਉਣਾ ਸਮੇਂ ਸਿਰ ਉਸਨੇ ਖੇਡਣਾ ਹੈ